ਹਾਂਜੀ ਸਾਡੇ ਜ਼ਿਲ੍ਹੇ ਵਿੱਚ ਕਈ ਪ੍ਰਕਾਰ ਦੇ ਸੰਗਠਨ ਹਨ ਜਿਨ੍ਹਾਂ ਵਿੱਚ ਨਹਿਰੂ ਯੁਵਾ ਕੇਂਦਰ ਇੱਕ ਹੈ ਇਹ ਸਾਡੇ ਜ਼ਿਲ੍ਹੇ ਵਿੱਚ ਹਰ ਸਾਲ ਹਰ ਸਾਲ ਨਹਿਰੂ ਸਟੇਡੀਅਮ ਦੇ ਵਿੱਚ ਵੱਖ ਵੱਖ ਪ੍ਰਕਾਰ ਦੀਆਂ ਖੇਡਾਂ ਦਾ ਆਯੋਜਨ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਜਿਸ ਵਿੱਚ ਕਈ ਪ੍ਰਕਾਰ ਦੀਆਂ ਗੇਮਾਂ ਅਥਲੈਟਿਕਸ ਅਤੇ ਹੋਰ ਗੇਮਾਂ ਜਿਵੇਂ ਬਾਸਕਿਟਬਾਲ ਵਾਲੀਵਾਲ ਕ੍ਰਿਕਟ ਬੈਡਮਿੰਟਨ ਅਥਲੈਟਿਕਸ ਦੇ ਵਿੱਚ ਫੋਰ ਹਨਡਰਡ ਮੀਟਰ ਰੇਸ ਟੂ ਹਨਡਰਡ ਏਟ ਹਨਡਰਡ ਆਦਿ ਇਨ੍ਹਾਂ ਵਿੱਚ ਕਈ ਪ੍ਰਕਾਰ ਦੇ ਬਹੁਤ ਜ਼ਿਆਦਾ ਬੱਚੇ ਇਨ੍ਹਾਂ ਵਿੱਚ ਹਿੱਸਾ ਲੈਂਦੇ ਹਨ ਵੱਧ ਚੜ੍ਹ ਕੇ ਜਿਨ੍ਹਾਂ ਵਿੱਚ ਕਾਫੀ ਜੋਸ਼ ਪਾਇਆ ਜਾਂਦਾ ਹੈ ਜੋ ਕਿ ਨਸ਼ਿਆਂ ਤੋਂ ਮੁਕਤ ਹੋ ਕੇ ਆਪਣਾ ਧਿਆਨ ਗਰਾਊਂਡ ਕੰਨੀ ਨੂੰ ਕੇਂਦਰਿਤ ਕਰਦੇ ਹਨ ਜਿਸ ਰਾਹੀਂ ਪੰਜਾਬ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਹੁਣ ਨਸ਼ਾ ਬਹੁਤ ਵੱਧ ਰਿਹਾ ਹੈ ਇਨ੍ਹਾਂ ਇਨ੍ਹਾਂ ਸੰਗਠਨਾਂ ਦਾ ਸਾਨੂੰ ਹੁਣ ਲਾਭ ਮਿਲ ਰਿਹਾ ਕਿ ਬੱਚੇ ਨਸ਼ਿਆਂ ਤੋਂ ਦੂਰ ਹੋ ਕੇ ਆਪਣਾ ਧਿਆਨ ਗਰਾਊਂਡ ਕੰਨੀ ਨੂੰ ਕੇਂਦਰਿਤ ਕਰਦੇ ਹਨ ਅਤੇ ਆਪਣੇ ਆਉਣ ਵਾਲੇ ਭਵਿੱਖ ਦਾ ਨੂੰ ਭਵਿੱਖ ਕੰਨੀ ਨੂੰ ਆਪਣਾ ਧਿਆਨ ਕੇਂਦਰਿਤ ਕਰਦੇ ਹਨ ਗਲਤ ਕੰਮਾਂ ਤੋਂ ਗਲਤ ਕੰਮਾਂ ਤੋਂ ਪਿੱਛੇ ਹੱਟ ਕੇ ਆਪਣਾ ਧਿਆਨ ਆਪਣੇ ਭਵਿੱਖ ਕੰਨੀ ਲਾਉਂਦੇ ਹਨ ਜੋ ਕਿ ਸਾਡੇ ਸਾਡੇ ਪੰਜਾਬ ਦੇ ਲਈ ਜਾਂ ਫਿਰ ਸਾਡੇ ਦੇਸ਼ ਦੇ ਲਈ ਬਹੁਤ ਵਧੀਆ ਹੈ ਕਿ ਸਾਡੇ ਦੇਸ਼ ਦੇ ਯੁਵਾ ਸਹੀ ਰਸਤੇ 'ਚ ਜਾ ਰਹੇ ਹਨ ਟੂਰਨਾਮੈਂਟ ਕਰਵਾਉਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਹੈ ਕਿ ਬੱਚੇ ਹਰ ਸਾਲ ਇਸ ਇਨ੍ਹਾਂ ਇਨ੍ਹਾਂ ਦੇ ਇੰਤਜ਼ਾਰ ਵਿੱਚ ਆਪਣੀ ਸਾਰਾ ਸਾਲ ਪ੍ਰੈਕਟਿਸ ਕਰਦੇ ਹਨ ਜਿਸ ਰਾਹੀਂ ਉਨ੍ਹਾਂ ਦਾ ਧਿਆਨ ਸਹੀ ਵਿਸ਼ੇ ਵੱਲ ਹੁੰਦਾ ਹੈ